ਬਾਗਬਾਨੀ ਦੇ ਸੰਬੰਧ ਵਿੱਚ ਜੇਕਰ ਆਪਾਂ ਗੱਲ ਕਰੀਏ ਤਾਂ ਮੈਂ ਆਪਣੇ ਜੀਵਨ ਦੀ ਗੱਲ ਕਰਾਂ ਤਾਂ ਬਾਗਬਾਨੀ ਮੇਰਾ ਸ਼ੁਰੂ ਤੋਂ ਹੀ ਮੁੱਖ ਸ਼ੌਕ ਰਿਹਾ ਹੈ ਕਿਉਂਕਿ ਮੈਂ ਇੱਕ ਖੇਤੀਬਾੜੀ ਨਾਲ਼ ਸੰਬੰਧਿਤ ਪਰਿਵਾਰ ਦੇ ਨਾਲ਼ ਪਰਿਵਾਰ ਦੇ ਵਿੱਚ ਮੇਰਾ ਜਨਮ ਹੋਇਆ ਅਤੇ ਮੇਰੇ ਪਿਤਾ ਜੀ ਅਤੇ ਮੇਰੇ ਮਾਤਾ ਜੀ ਉਹ ਖੇਤੀਬਾੜੀ ਵੀ ਕਰਦੇ ਸੀ ਇਸ ਤੋਂ ਇਲਾਵਾ ਸਾਡੇ ਘਰ ਦੇ ਪਿਛਲੇ ਪਾਸੇ ਪਿਛਲੇ ਵਿਹੜੇ ਦੇ ਵਿੱਚ ਕਾਫ਼ੀ ਖੁੱਲ੍ਹੀ ਥਾਂ ਸੀ ਜਿੱਥੇ ਵੱਖ ਵੱਖ ਤਰ੍ਹਾਂ ਦੀਆਂ ਅਸੀਂ ਸਬਜ਼ੀਆਂ ਉਗਾਉਂਦੇ ਸੀ ਅਤੇ ਗਰਮੀਆਂ ਦੇ ਵਿੱਚ ਰਾਮ ਤੋਰੀਆਂ ਖੀਰੇ ਟਮਾਟਰ ਘਈਆ ਕੱਦੂ ਅਤੇ ਇਸ ਤਰ੍ਹਾਂ ਦੀਆਂ ਵੱਖ ਵੱਖ ਸਬਜ਼ੀਆਂ ਅਤੇ ਸਰਦੀਆਂ ਦੇ ਲਈ ਪਾਲਕ ਮੇਥੀ ਮੇਥੇ ਸਾਗ ਇਸ ਤਰ੍ਹਾਂ ਦੀਆਂ ਵੱਖ ਵੱਖ ਸਬਜ਼ੀਆਂ ਅਸੀਂ ਉਗਾਉਂਦੇ ਸੀ ਅਤੇ ਸ਼ੁਰੂ ਤੋਂ ਕਿਉਂਕਿ ਇਸ ਤਰ੍ਹਾਂ ਦੇ ਮਾਹੌਲ ਵਿੱਚ ਰਹਿਣ ਕਰਕੇ ਮੈਨੂੰ ਵੀ ਸ਼ੌਕ ਪੈਦਾ ਹੋ ਗਿਆ ਕਿ ਮੈਂ ਵੀ ਬਾਗਬਾਨੀ ਦੇ ਵਿੱਚ ਆਪਣਾ ਕੰਮ ਕਰ ਸਕਾਂ ਅਤੇ ਇਸ ਤਰ੍ਹਾਂ ਮੈਂ ਆਪਣੀ ਨੌਕਰੀ ਦੇ ਦੌਰਾਨ ਵੱਖ ਵੱਖ ਸ਼ਹਿਰਾਂ ਦੇ ਵਿੱਚ ਜਿੱਥੇ ਵੀ ਮੇਰੀ ਪੋਸਟਿੰਗ ਹੁੰਦੀ ਰਹੀ ਮੇਰੀ ਕੋਸ਼ਿਸ਼ ਹੁੰਦੀ ਸੀ ਕਿ ਮੈਂ ਆਪਣੇ ਘਰ ਦੇ ਨਾਲ਼ ਇੱਕ ਛੋਟਾ ਜਿਹਾ ਕਿਚਨ ਗਾਰਡਨ ਜਿਹਨੂੰ ਆਪਾਂ ਰਸੋਈ ਨਾਲ਼ ਸੰਬੰਧਿਤ ਬਾਗ਼ ਬਗੀਚੀ ਕਹਿ ਸਕਦੇ ਹਾਂ ਉਹ ਜ਼ਰੂਰ ਬਣਾਵਾਂ ਅਤੇ ਹੁਣ ਅੰਮ੍ਰਿਤਸਰ ਦੇ ਵਿੱਚ ਵੀ ਯੂਨੀਵਰਸਿਟੀ ਦੇ ਕੈਂਪਸ ਵਿੱਚ ਰਹਿੰਦੇ ਹੋਏ ਮੈਨੂੰ ਇੱਥੇ ਕਾਫ਼ੀ ਖੁੱਲ੍ਹੀ ਥਾਂ ਮਿਲੀ ਹੋਈ ਹੈ ਅਤੇ ਪਾਣੀ ਦੀ ਵੀ ਕੋਈ ਸਮੱਸਿਆ ਨਹੀਂ ਹੈ ਇਸ ਲਈ ਮੈਂ ਕੋਸ਼ਿਸ਼ ਕਰਦਾ ਹਾਂ ਕਿ ਹਫ਼ਤੇ ਦੇ ਵਿੱਚ ਚਾਰ ਘੰਟੇ ਪੰਜ ਘੰਟੇ ਜਿੰਨਾ ਵੀ ਸਮਾਂ ਮੈਨੂੰ ਮਿਲ ਸਕੇ ਮੈਂ ਉੱਥੇ ਆਪਣੀ ਬਾਗ ਬਗਾਨ ਬਾਗਬਾਨੀ ਨਾਲ਼ ਸੰਬੰਧਿਤ ਆਪਣਾ ਸ਼ੌਕ ਪੂਰਾ ਕਰਨ ਲਈ ਉੱਥੇ ਸਮਾਂ ਬਤੀਤ ਕਰਦਾ ਹਾਂ ਅਤੇ ਇਸ ਸ਼ੌਕ ਦ ਦੇ ਨਾਲ਼ ਮੈਨੂੰ ਚੰਗੀਆਂ ਔਰਗੈਨਿਕ ਸ਼ੁੱਧ ਬਿਨਾਂ ਕਿਸੇ ਸਪਰੇਅ ਵਗੈਰਾ ਤੋਂ ਚੰਗੀਆਂ ਸਬਜ਼ੀਆਂ ਪ੍ਰਾਪਤ ਹੁੰਦੀਆਂ ਹਨ ਅਤੇ ਜਿਹਦੇ ਨਾਲ਼ ਮੇਰੀ ਅਤੇ ਮੇਰੇ ਪਰਿਵਾਰ ਦੀ ਸਿਹਤ ਵੀ ਚੰਗੀ ਰਹਿੰਦੀ ਹੈ ਧੰਨਵਾਦ ਜੀ